ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਵਿੱਚ ਲੋਕਾਂ ਨੂੰ ਇਕੱਠਿਆਂ ਕਰਦੀਆਂ ਹਨ ਅ ਖੇਡਾਂ ਵਿੱਚ ਲੋਕ ਜੋ ਖੇਡਾਂ ਦੇਖਣ ਲੋਕ ਆਉਂਦੇ ਹਨ ਉਸ ਵਿੱਚ ਲੋਕ ਇਕੱਠਿਆਂ ਬਹਿ ਕੇ ਦੇਖਦੇ ਹਨ ਜਾਂ ਸਾਡੇ ਪੰਜਾਬ ਵਿੱਚ ਅਜਿਹੀਆਂ ਖੇਡਾਂ ਹਨ ਜਿਸ ਵਿੱਚ ਸਾਰੇ ਲੋਕ ਇਕੱਠੇ ਬਹਿ ਕੇ ਖੇਡਾਂ ਨੂੰ ਦੇਖਦੇ ਹਨ ਜਿਵੇਂ ਕਿ ਕਬੱਡੀ ਵਿੱਚ ਲੋਕ ਇਕੱਠੇ ਦੇਖਦੇ ਹਨ ਕਿਉਂਕਿ ਉਸ ਵਿੱਚ ਲੋਕ ਭਾਰੀ ਭਾਰੀ ਉਸ ਉਸ ਉਤਸ਼ਾਹ ਨਾਲ ਖੇਡਾਂ ਦੇਖਦੇ ਹਨ ਤਾਂ ਜੋ ਕਿ ਵਧੀਆ ਢੰਗ ਨਾਲ ਲੋਕ ਖੇਡਾਂ ਦੇਖਣ ਦਿਖਣ ਦੇਖਣ ਦੇਖ ਸਕਣ ਪੰਜਾਬ ਵਿੱਚ ਸਾਰੀਆਂ ਲੋਕ ਸਾਰੀਆਂ ਖੇਡਾਂ ਹੀ ਦੇਖਦੇ ਹਨ ਪਰ ਜ਼ਿਆਦਾਤਰ ਪ ਕਬੱਡੀ ਕਬੱਡੀ ਦੌੜਾਂ ਅਤੇ ਹੋਰ ਕਈ ਇਹੋ ਜਿਹੀਆਂ ਖੇਡਾਂ ਹਨ ਜੋ ਕਿ ਲੋਕਾਂ ਨੂੰ ਇਕੱਠਾ ਕਰਦੀਆਂ ਹਨ ਕਿਉਂਕਿ ਖੇਡਾਂ ਨਾਲ ਹੀ ਲੋਕ ਖੁਸ਼ ਹੁੰਦੇ ਹਨ ਖੇਡਾਂ ਵਿੱਚ ਟੀਮ ਵਰਕ ਹੁੰਦੀ ਹੈ ਜਿਸ ਨਾਲ ਲੋਟ ਲੋਕ ਟੀਮ ਟੀਮਾਂ ਨੂੰ ਵੀ ਸਹਿਯੋਗ ਉੱਤੇ ਅਹਿਸਾਸ ਕਰਦੀਆਂ ਹਨ ਲੋ ਜੇ ਖੇਡਾਂ ਨਾਲ ਹੀ ਲੋਕ ਉਤਸ਼ਾਹ ਹੁੰਦੇ ਹਨ ਤਾਂ ਜੋ ਕਿ ਪੰਜਾਬ ਵਿੱਚ ਲੋਕ ਇਕੱਠੇ ਬੈਠ ਕੇ ਖੇਡਾਂ ਦੇਖ ਸਕਣ ਤਾਂ ਜੋ ਕੀ ਕੀ ਕੋਈ ਇੱਕ ਦੂਜੇ ਤੋਂ ਉਰਾਂ ਪਰਾਂ ਨਾ ਹੋ ਸਕਣ ਪੰਜਾਬ ਲੋਕ ਸਾਰੇ ਵੱਖ ਵੱਖ ਖੇਡਾਂ ਦੇਖਣ ਦੇ ਸ਼ੌਕੀਨ ਹਨ ਜ਼ਿਆਦਾਤਰ ਪੰਜਾ ਕਬੱਡੀ ਕਬੱਡੀ ਬੈਲ ਦੌੜਾਂ ਬੈਲ ਦੌੜਾਂ ਅਤੇ ਹੋਰ ਵੀ ਅਜਿਹੀਆਂ ਖੇਡਾਂ ਹਨ ਲੋਕ ਲੋਕ ਇਕੱਠਿਆਂ ਬਹਿ ਕੇ ਦੇਖਦੇ ਹਨ ਅਤੇ ਉ ਇਹ ਇਹ ਖੇਡਾਂ ਲੋਕਾਂ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਲੋਕ ਟੀਮ ਵਰਕਰ 'ਤੇ ਟੀਮ ਵਰਕ ਨੂੰ ਸਹਿਯੋਗ ਦਿੰਦੇ ਹਨ ਤਾਂ ਜੋ ਕਿ ਲੋਕ ਹੋਰ ਕਈ ਖੇਡਾਂ ਕਰਵਾ ਸਕਣ ਜਿਸ ਨਾਲ ਲੋਕ ਇਕੱਠੇ ਬਹਿ ਕੇ ਖੇਡਾਂ ਖੇਡ ਸਕਣ ਅਤੇ ਪੰਜਾਬ ਵਿੱਚ ਲੋਕ ਇਕੱਠੇ ਹੋ ਸਕਣ ਖੇਡਾਂ ਦੇ ਨਾਲ ਨਾਲ ਲੋਕ ਹੋਰਾਂ ਕਈਆਂ ਮੇਲਿਆਂ ਵਿੱਚ ਵੀ ਇਕੱਠੇ ਹੁੰਦੇ ਹਨ ਕਿਉਂਕਿ ਮੇਲਿਆਂ ਵਿੱਚ ਖੇਡਾਂ ਖੇਡਾਂ ਲੋਕਾਂ ਨੂੰ ਇਕੱਠਿਆਂ ਕਰਦੀ ਹੈ ਲੋਕ ਕਬੱਡੀ ਦੇਖਦੇ ਹਨ ਮੇਲਾ ਦੇਖਦੇ ਹਨ ਅਤੇ ਹੋਰ ਹੋਰ ਵੀ ਮੇਲਿਆਂ ਵਿੱਚ ਖੇਡਾਂ ਦੇਖਦੇ ਹਨ ਧੰਨਵਾਦ ਜੀ